ਹਾਂਜੀ ਭਾਰਤ ਵਿੱਚ ਪੰਜਾਬ ਇੱਕ ਐਸਾ ਦੇਸ਼ ਹੈ ਜਿਸਨੇ ਕਾਫ਼ੀ ਆਜ਼ਾਦੀ ਦੀ ਲੜਾਈਆਂ ਵਿੱਚ ਯੋਗਦਾਨ ਪਾਇਆ ਸੀਗਾ ਅਤੇ ਭਾਈਚਾਰੇ ਦੀ ਗੱਲ ਕਰੀਏ ਤਾਂ ਕਾਫ਼ੀ ਜ਼ਿਆਦਾ ਭਾਈਚਾਰ ਪੰਜਾਬੀਆਂ ਦੇ ਵਿੱਚ ਹਿੰਦੂਆਂ ਦੇ ਵਿੱਚ ਅਤੇ ਮੁਸਲਮਾਨਾਂ ਦੇ ਵਿੱਚ ਕਾਫ਼ੀ ਭਾਈਚਾਰਾ ਗਾ ਸਾਂਝਾ ਦੇਸ਼ ਹੈ ਪੰਜਾਬ ਅਤੇ ਇਸ ਨੂੰ ਇਸ ਨੂੰ ਦੇਖਦੇ ਹੋਏ ਕੁਛ ਰਾਜਨੀਤਿਕ ਤੱਥਾਂ ਨੇਤਾਵਾਂ ਨੇ ਉੱਨੀ ਸੌ ਚੁਰਾਸੀ ਦੇ ਵਿੱਚ ਵੀ ਕਾਫ਼ੀ ਲੜਾਈਆਂ ਦੀਆਂ ਲੜਾਈ ਹੋਈ ਕਾਫ਼ੀ ਅਤੇ ਉਸ ਦ ਲੜਾਈ ਦੇ ਵਿੱਚ ਕਾਫ਼ੀ ਨਿਰਦੋਸ਼ ਬੰਦੇ ਵੀ ਮਾਰੇ ਗਏ ਸੀ ਜਿਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਮਿਲ ਸਕਿਆ ਸੋ ਉਸ ਦੌਰ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਅੱਜ ਵੀ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਆਪਸ ਕ ਪੜ੍ਹਾਈ 'ਚ ਲੜਾਈਆਂ ਕਰਵਾਈਆਂ ਜਾਂਦੀਆਂ ਹਨ ਸੋ ਨਿੱਜੀ ਜ਼ਿੰਦਗੀ ਦੇ ਵਿੱਚ ਅਨੁਭਵ ਇਹ ਹੈ ਕਿ ਕਿ ਮੋਹਾਲੀ ਦੇ ਵਿੱਚ ਜੋ ਇੱਕ ਜੋ ਸਰਸੇ ਵਾਲਾ ਬਾਬਾ ਸੀਗਾ ਉਹਨੂੰ ਇੱਕ ਮਹਾਨ ਮੇਨ ਕਿਰਦਾਰ ਬਣਾਇਆ ਗਿਆ ਗਾ ਸੋ